ਹਾਂ ਮੈਂ ਸਾਈਬਰ ਧੱਕੇਸ਼ਾਹੀ ਅਤੇ ਸੋਸ਼ਲ ਮੀਡੀਆ ਟਰੋਲਿੰਗ ਤੋਂ ਚੰਗੀ ਤਰ੍ਹਾ ਜਾਣੂ ਹਾਂ ਮੈਂ ਕਈ ਲੋਕਾਂ ਨਾਲ ਸਾਈਬਰ ਧੱਕੇਸ਼ਾਹੀ ਜਿਵੇਂ ਕਿ ਕਿਸੇ ਦਾ ਪਿਨ ਕੋਡ ਲੈ ਲੈਣਾ ਜਾਂ ਓ ਟੀ ਪੀ ਲੈ ਕੇ ਉਸ ਦੇ ਸਾਰੇ ਪੈਸੇ ਕਢਾ ਲੈਂਦੇ ਹਨ ਅਤੇ ਸੋਸ਼ਲ ਮੀਡੀਆ ਦੇ ਲੋਕ ਜੋ ਕਿਸੇ ਨੂੰ ਟਰੋਲ ਕਰਦੇ ਹਨ ਉਹ ਬਹੁਤ ਹੀ ਗੱਲਤ ਵਿਵਹਾਰ ਹੈ ਇਸ ਤਰ੍ਹਾ ਦੇ ਲੋਕਾਂ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਆਪਣੇ ਏ ਟੀ ਐਮ ਦਾ ਪਿਨ ਕੋਡ ਔਰ ਕਦੇ ਵੀ ਆਪਣਾ ਓ ਟੀ ਪੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਇਹਨਾਂ ਮੁੱਦਿਆਂ ਤੋਂ ਆਪਾਂ ਨੂੰ ਰਲ ਮਿਲ ਕੇ ਨਜਿੱਠਣਾ ਚਾਹੀਦਾ ਔਰ ਇਕ ਦੂਸਰੇ ਨੂੰ ਸੂ ਸੂਚਿਤ ਸੂਚਿਤ ਕਰਦੇ ਰਹਿਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਬੁਰੇ ਅਨਸਰ ਜੋ ਹੈ ਉਹਨਾਂ ਤੋਂ ਬਚਣਾ ਚਾਹੀਦਾ ਮੇਰੇ ਨਾਲ ਅਜੇ ਤੱਕ ਕੋਈ ਵੀ ਇਸ ਤਰ੍ਹਾਂ ਦਾ ਬੁਰਾ ਵਿਵਹਾਰ ਨਹੀਂ ਹੋਇਆ ਮੈਂ ਇਸ ਸਾਈਬਰ ਕ੍ਰਾਈਮ ਦੇ ਧੋਖੇ ਤੋਂ ਚੰਗੀ ਤਰਾਂ ਜਾਣੂ ਅਤੇ ਸਾਵਧਾਨ ਰਹਿੰਦਾ ਹਾਂ